ਸਾਡੇ ਖੇਤਰ ਦੇ ਵਿੱਚ ਕੁਪੋਸ਼ਣ ਦੀ ਸਮੱਸਿਆ ਹੈ ਕਿਉਂਕਿ ਜਿਹੜਾ ਸਾਡੇ ਏਰੀਏ ਦਾ ਪਾਣੀ ਹੈ ਉਹ ਸਾਫ਼ ਨਹੀਂ ਹੈਗਾ ਅਤੇ ਜਿਹੜੇ ਬੱ ਚੰਗੀ ਤਰ੍ਹਾਂ ਨਾਲ ਖਾਣਾ ਨਹੀਂ ਮਿਲਦਾ ਅਸੀਂ ਆਪਣੀ ਸਰਕਾਰ ਨੂੰ ਇਹ ਹੀ ਸ ਅਪੀਲ ਕਰਦੇ ਹਾਂ ਵੀ ਜਿਹੜਾ ਪਾਣੀ ਦਾ ਪ੍ਰਬੰਧ ਹੈ ਉਹ ਚੰਗਾ ਹੋਵੇ ਅਤੇ ਸਾਫ਼ ਹੋਵੇ